ਸਾਡੇ ਸੱਭਿਆਚਾਰ ਵਿੱਚ ਮੁੱਖ ਕਿੱਤਾ ਖੇਤੀਬਾੜੀ ਅਤੇ ਪਸ਼ੂ ਪਾਲਣ ਦਾ ਹੈ ਖੇਤੀਬਾੜੀ ਵਿੱਚ ਅੱਜ ਕੱਲ੍ਹ ਮਹਿੰਗੇ ਬੀਜ ਮਹਿੰਗੇ ਬੀਜ ਨੇ ਅਤੇ ਸਭ ਲੋਕ ਕਰਵਾਏ ਕਿਰਾਏ 'ਤੇ ਕੰਮ ਕਰਵਾਉਂਦੇ ਹਨ ਇਸ ਲਈ ਖੇਤੀਬਾੜੀ ਵਿੱਚ ਇੰਨਾਂ ਮੁਨਾਫ਼ਾ ਨਹੀਂ ਹੈ ਇਸ ਕਰਕੇ ਲੋਕ ਸ਼ਹਿਰਾਂ ਵੱਲ ਜਾ ਰਹੇ ਹਨ ਸ਼ਹਿਰਾਂ ਵਿੱਚ ਲੋਕ ਫੈਕਟਰੀਆਂ ਵਿੱਚ ਜਾ ਰਹੇ ਹਨ ਜ਼ਿਆਦਾ ਤੋਂ ਜ਼ਿਆਦਾ ਫੈਕਟਰੀਆਂ ਵਿੱਚ ਜਾ ਰਹੇ ਹਨ ਕੋਈ ਆਪਣਾ ਕੰਮ ਸ਼ੁਰੂ ਕਰ ਰਿਹਾ ਹੈ ਕੋਈ ਦੁਕਾਨ ਪਾ ਰਿਹਾ ਹੈ ਇਸ ਕਰਕੇ ਸਭ ਲੋਕ ਸ਼ਹਿਰਾਂ ਵੱਲ ਨੂੰ ਜਾ ਰਹੇ ਹਨ ਪਸ਼ੂ ਪਾਲਣ ਪਸ਼ੂ ਪਾਲਣ ਵਿੱਚ ਲੋਕ ਲੋਨ ਲੈ ਕੇ ਪਸ਼ੂ ਪਾ ਲੈਂਦੇ ਹਨ ਅਤੇ ਦੁੱਧ ਦੀ ਪੈਦਾਵਾਰ ਉੱਨੀ ਨਹੀਂ ਹੁੰਦੀ ਪੈਦਾਵਾਰ ਘੱਟ ਹੋਣ ਕਰਕੇ ਲੋਕਾਂ ਦੇ ਪੈਸੇ ਵੀ ਖਰਾਬ ਹੁੰਦੇ ਹਨ ਇਸ ਕਰਕੇ ਲੋਕਾਂ ਨੂੰ ਲੋਨ ਨਹੀਂ ਮਿਲਦੇ ਹਨ ਤਾਂ ਜੋ ਲੋਕ ਪਸ਼ੂ ਪਾਲਣ ਦਾ ਧੰਦਾ ਵੀ ਛੱਡਦੇ ਜਾ ਰਹੇ ਹਨ